ਵੈਸੇ ਤਾਂ ਅੱਜ ਕੱਲ ਹਰ ਕੋਈ ਰੀਲਾਂ ਜਾਂ ਸ਼ੋਟਸ ਬਣਾਉਂਦਾ ਹੈ ਇੰਸਟਾਗ੍ਰਾਮ ਉੱਤੇ ਰੀਲਸ ਚੱਲਦੀਆਂ ਨੇ ਅਤੇ ਯੂਟਿਊਬ ਉੱਤੇ ਸ਼ੋਟਸ ਚੱਲਦੇ ਨੇ ਵੈਸੇ ਤਾਂ ਇਹ ਫੋਟੋ ਖਿੱਚਣ ਨਾਲੋਂ ਕਾਫੀ ਅਲੱਗ ਹੈ ਜਿੱਥੇ ਅਸੀਂ ਫੋਟੋ ਖਿੱਚਣ ਵਾਸਤੇ ਲੋਕੇਸ਼ਨ ਵਗੈਰਾ ਵੇਖਦੇ ਹਾਂ ਜਾਂ ਜਗ੍ਹਾ ਵੇਖਦੇ ਹਾਂ ਕਿੱਥੇ ਸਾਡੀ ਫੋਟੋ ਵਧੀਆ ਆਉਂਦੀ ਆ ਉੱਥੇ ਸ਼ੋਟਸ ਬਣਾਉਣ ਵਿੱਚ ਅਸੀਂ ਕਾਫੀ ਸਾਰੀ ਲੋਕੇਸ਼ਨਾਂ ਵੇਖ ਦਿੰਦੇ ਹਾਂ ਇੱਕ ਪੰਦਰਾਂ ਸਕਿੰਟ ਦੀ ਸ਼ੋਟਸ ਨੂੰ ਬਣਾਉਣ ਦੇ ਵਿੱਚ ਕਾਫੀ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਜਿੱਥੇ ਇੱਕ ਕਲਿੱਕ ਦੇ ਵਿੱਚ ਤੁਸੀਂ ਫੋਟੋ ਕਲਿੱਕ ਕਰ ਸਕਦੇ ਹੋ ਉੱਥੇ ਤੁਹਾਨੂੰ ਇੱਕ ਪੰਦਰਾਂ ਸਕਿੰਟ ਦੀ ਸ਼ੋਟਸ ਬਣਾਉਣ ਲਈ ਇੱਕ ਚੰਗਾ ਕੰਟੇਂਟ ਚਾਹੀਦਾ ਹੁੰਦਾ ਹੈ ਜ਼ਰੂਰੀ ਨਹੀਂ ਹੈ ਕਿ ਟਾਈਮ ਹੀ ਬਰਬਾਦ ਕਰਦਾ ਹੈ ਤੁਹਾਨੂੰ ਇੱਕ ਚੰਗੀ ਸ਼ੋਟ ਬਣਾਉਣ ਲਈ ਇੱਕ ਚੰਗਾ ਕੰਟੈਂਟ ਵੀ ਚਾਹੀਦਾ ਹੈ ਇੱਕ ਚੰਗੀ ਸ਼ੋਟ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਇੱਕ ਟਾਈਮ ਵੇਸਟ ਵੀ ਹੁੰਦਾ ਹੈ ਕਈ ਵਾਰੀ ਟਾਈਮ ਵੇਸਟ ਕਰਨਾ ਵੀ ਕੋਈ ਜ਼ਰੂਰੀ ਨਹੀਂ ਹੈ ਕਿ ਮਾੜਾ ਹੀ ਹੋਵੇ ਗੱਲ ਵੈਸੇ ਤਾਂ ਸ਼ੋਟਸ ਬਣਾਉਣਾ ਵੀ ਕਾਫੀ ਇੱਕ ਵਧੀਆ ਗੱਲ ਹੈ ਕਿਉਂਕਿ ਕਾਫੀ ਸਾਰਾ ਵੱਡਾ ਕੋਨਟੈਂਟ ਵੀ ਤੁਹਾਨੂੰ ਛੋਟੇ ਪੰਦਰਾਂ ਸਕਿੰਟ ਦੇ ਸ਼ੋਟਸ ਦੇ ਵਿੱਚ ਮਿਲ ਜਾਂਦਾ ਹੈ ਕਾਫੀ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਰੀਲਾਂ ਦੇ ਸ਼ੋਟਸ ਦੇ ਦੇ ਤਰੀਕੇ ਨੂੰ ਅਸੀਂ ਸਹੀ ਤਰੀਕੇ ਨਾਲ ਵਰਤੀਏ ਵੈਸੇ ਤਾਂ ਇਸ ਤੋਂ ਸਾਨੂੰ ਕਾਫੀ ਜ਼ਿਆਦਾ ਕੋਨਟੈਂਟ ਵੀ ਮਿਲ ਜਾਂਦਾ ਹੈ ਕਾਫੀ ਲੋਕ ਆਪਣੇ ਪੜ੍ਹਾਈ ਦੇ ਰਿਲੇਟਡ ਵੀ ਕੋਨਟੈਂਟ ਚਾੜ੍ਹਦੇ ਨੇ ਕਾਫੀ ਲੋਕ ਆਪਣੇ ਸਾਨੂੰ ਐਂਟਰਟੇਨ ਕਰਨ ਲਈ ਵੀ ਕੋਨਟੈਂਟ ਚਾੜ੍ਹਦੇ ਨੇ ਪਰ ਸ਼ੋਟਸ ਅਤੇ ਰੀਲਸ ਦਾ ਇੱਕ ਜ਼ਮਾਨਾ ਹੀ ਆ ਚੁੱਕਿਆ ਹੈ ਅੱਜ ਕੱਲ ਹਰ ਕੋਈ ਸ਼ੋਟਸ ਅਤੇ ਰੀਲ ਹੀ ਬਣਾਉਂਦਾ ਪਿਆ ਹੈ ਜਿਹਦੇ ਕਰਕੇ ਲੋਕਾਂ ਦੇ ਵਿੱਚ ਸਬਰ ਵੀ ਮੁੱਕਦਾ ਜਾ ਰਿਹਾ ਹੈ ਇਸ ਲਈ ਮੇਰੇ ਹਿਸਾਬ ਨਾਲ ਸ਼ੋਟਸ ਅਤੇ ਰੀਲਸ ਤੁਸੀਂ ਚਲਾਓ ਪਰ ਇੱਕ ਚੰਗਾ ਕੋਨਟੈਂਟ ਵੇਖਣ ਲਈ ਚਲਾਓ ਇਹ ਨਹੀਂ ਕਿ ਤੁਸੀਂ ਦੂਸਰਾ ਹੀ ਕੋਨਟੈਂਟ ਵੇਖਣਾ ਹੈ ਜੋ ਸਾਰਿਆਂ ਨੂੰ ਉਹੀ ਕਰਦਾ ਹੋਵੇ ਭੜਕਾਉਂਦਾ ਹੋਵੇ ਜਾਂ ਕਿਸੇ ਨੂੰ ਦੇ ਦਿਮਾਗ ਨੂੰ ਹਰਾਸ ਕਰਦਾ ਹੋਵੇ ਇਸ ਲਈ ਚੰਗਾ ਕੋਨਟੈਂਟ ਦੇਣਾ ਸਾਨੂੰ ਸਭ ਤੋਂ ਵੱਧ ਜ਼ਰੂਰੀ ਹੈ ਥੈਂਕ ਯੂ